ਹੈਲੋ ਹਾਂਜੀ ਜੀ ਅੱਛਾ ਜੀ ਕੀ ਸਾਈਜ਼ ਆ ਸਰ ਠੀਕ ਆ ਜੀ ਅਤੇ ਸਰ ਕਿੰਨੀ ਇਕੱਲਾ ਬੋਰਡ 'ਚ ਜਾਂ ਪੋਲਿਸ਼ ਕਰਵਾਉਣੀ ਤੁਸੀਂ ਪੋਲਿਸ਼ ਕਰਵਾਉਣੀ ਸਰ ਕਿ ਸਨਮੈਕਾ ਲਵਾਉਣਾ ਤੁਸੀਂ ਸਨਮੈਕਾ ਲਗਵਾਉਣਾ ਕਿੰਨੇ ਕੁ ਬਜਟ ਦਾ ਤੁਹਾਡਾ ਸਰ ਸਨਮੈਕੇ ਅਤੇ ਵਿੱਚ ਵੀ ਕਈ ਵਰਾਇਟੀਆਂ ਆਉਂਦੀਆਂ ਨਾ ਅਲੱਗ ਅਲੱਗ ਉਹਦੇ ਕਰਕੇ ਬਜਟ ਥੋੜ੍ਹਾ ਉੱਪਰ ਥੱਲੇ ਹੋ ਜਾਂਦਾ ਪੰਜ ਹਜ਼ਾਰ ਤੋਂ ਲੱਗ ਕੇ ਹਾਂ ਜੇ ਸਿੰਗਲ ਬੈਡ ਆ ਸਰ ਤਾਂ ਉਹ ਦਸ ਤੋਂ ਬਾਰ੍ਹਾਂ ਹਜ਼ਾਰ ਤੱਕ ਵਧੀਆ ਬਣ ਜਾਂਦਾ ਜੀ ਡਬਲ ਬੈਡ ਸਰ ਉਹੀ ਮੇਰੇ ਕੋਲ ਕੋਈ ਵੀਹ ਤੋਂ ਤੀਹ ਦੇ ਵਿੱਚ ਵਿੱਚ ਵਧੀਆ ਸਨਮਾਇਕਾ ਲਗਾ ਕੇ ਹਾਂ ਜੀ ਸਰ ਫਿਰ ਉਹੀ ਤੀਹ ਕੁ ਹਜ਼ਾਰ ਤੱਕ ਵਿੱਚ ਢੋਹ ਢੋਹ ਵਗੈਰਾ ਸਾਰਾ ਲਾ ਕੇ ਹਾਂਜੀ ਉਹ ਕਰ ਦਾਂਗੇ ਸਰ ਬਾਕੀ ਸਰ ਆਪਾਂ ਕਰ ਲਾਂਗੇ ਆ ਜਿਓ ਸ਼ੋਪ 'ਤੇ ਆ ਜਿਓ ਨਾ ਹਾਂਜੀ ਠੀਕ ਹੈ ਸਰ ਕੁਛ ਐਡਵਾਂਸ ਲੈ ਕੇ ਨਾ ਆਪਾਂ ਫਿਰ ਕਰ ਲਵਾਂਗੇ ਠੀਕ ਐ ਓਕੇ